ਹਾਂ ਪੰਛੀਆਂ ਦੇ ਸ਼ਿਕਾਰ ਨੂੰ ਲੈ ਕੇ ਛੋਟੇ ਹੁੰਦਿਆਂ ਦੀ ਇੱਕ ਯਾਦ ਹੈਗੀ ਹੈ ਜਿਹੜੀ ਅਜੇ ਤੱਕ ਬੜੀ ਡੂੰਘੀ ਜਿਹਨੇ ਮਨ 'ਤੇ ਅਸਰ ਕੀਤਾ ਸੀਗਾ ਸਾਡੇ ਗੁਆਂਢ ਦੇ ਵਿੱਚ ਇੱਕ ਉਫ ਰਿਟਾਇਰਡ ਫੌਜੀ ਸਾਹਿਬ ਸੀਗੇ ਉਹਨਾਂ ਨੂੰ ਸ਼ਿਕਾਰ ਦਾ ਬੜਾ ਸ਼ੌਂਕ ਸੀਗਾ ਔਰ ਸਾਡੇ ਏਰੀਏ ਦੇ ਵਿੱਚ ਜਿਹੜਾ ਹੈਗਾ ਤਿੱਤਰ ਅਤੇ ਬਟੇਰ ਜਿਹੜੇ ਹੈਗੇ ਨੇ ਆਮ ਮਿਲ ਜਾਂਦੇ ਸੀਗੇ ਅਤੇ ਫੌਜੀ ਸਾਹਿਬ ਨੇ ਕਈ ਵਾਰ ਸ਼ਿਕਾਰ ਕਰਕੇ ਲੈ ਕੇ ਆਉਣਾ ਉਮਰ ਵੀ ਛੋਟੀ ਸੀ ਅਸੀਂ ਪੰਛੀਆਂ ਨੂੰ ਜਿਹੜਾ ਹੈਗਾ ਉਹਨਾਂ ਦੇ ਹੱਖੀਂ ਮਰਦਿਆਂ ਦੇਖਿਆ ਹੈਗਾ ਸ਼ਿ ਉਹਨਾਂ ਨੂੰ ਸ਼ਿਕਾਰ ਕਰਦਿਆਂ ਦੇਖਿਆ ਹੈਗਾ ਅਤੇ ਥੋੜ੍ਹਾ ਅਫਸੋਸ ਹੁੰਦਾ ਸੀਗਾ ਹੈ ਤਾਂ ਜੀਵ ਜੰਤੂ ਹੀ ਹੈਗੇ ਨੇ ਅਤੇ ਉਹਦਾ ਮਨ 'ਤੇ ਕਾਫ਼ੀ ਗਹਿਰਾ ਪ੍ਰਭਾਵ ਰਿਹਾ ਅਤੇ ਉਹਦੇ ਕਰਕੇ ਚਲੋ ਇੱਕ ਇਹ ਵੀ ਪਾਰਟ ਹੋਇਆ ਵੀ ਜਿਹੜਾ ਹੈਗਾ ਅਸ ਮੈਂ ਜਿਹੜਾ ਹੈਗਾ ਨਾਨ ਵੈਜ ਖਾਣਾ ਬੰਦ ਕਰ ਦਿੱਤਾ ਵੀ ਇੱਕ ਜੀਵ ਦੀ ਹੱਤਿਆ ਕਰਕੇ ਉਹਨੂੰ ਖਾਣਾ ਇੱਕ ਬੜੀ ਵੱਡੀ ਗਲਤ ਹੈਗੀ ਹੈ ਜੋ ਮੇਰੇ ਮਨ 'ਚ ਉਹਦਾ ਉਸ ਚੀਜ਼ ਦਾ ਪ੍ਰਭਾਵ ਪਿਆ ਦੂਸਰਾ ਕਈਆਂ ਨੇ ਜਿਹੜਾ ਹੈਗਾ ਜਾਲ ਵਿਛਾਇਆ ਹੁੰਦਾ ਸੀਗਾ ਕਬੂਤਰਾਂ ਨੂੰ ਫੜਨ ਦੇ ਲਈ ਅਤੇ ਉਹਦੇ 'ਚ ਮੇਰੀ ਇੱਕ ਆਪਣੀ ਇੱਕ ਹੋਰ ਯਾਦ ਸਾਂ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਵਾਂਗਾ ਉਹਦੇ ਵਿੱਚ ਕੀ ਸੀਗਾ ਜਿਹੜੇ ਜਾਲ ਦੇ ਵਿੱਚ ਦੋ ਕਬੂਤਰ ਫਸੇ ਸੀਗੇ ਮੈਂ ਅੱਖ ਚੁਰਾ ਕੇ ਉਹਨਾਂ ਨੂੰ ਜਿਹੜਾ ਹੈਗਾ ਉਹ ਜਾਲ ਚੋਂ ਕੱਢ ਕੇ ਉੜਾ ਦਿੱਤਾ ਸੀਗਾ ਧੰਨਵਾਦ ਜੀ